ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਦੁਕਾਨਾਂ ਹਨ ਅਤੇ ਉਹਨਾਂ ਵਿੱਚ ਜ਼ਿਆਦਾਤਰ ਦੁਕਾਨਾਂ ਕਰਿਆਨੇ ਦੀਆਂ ਹਨ ਜਿਹਨਾਂ ਵਿੱਚ ਜਾਕੇ ਅਸੀਂ ਆਪਣਾ ਡੇਲੀ ਵਰਤੋਂ ਦਾ ਸਮਾਨ ਖਰੀਦਦੇ ਹਨ ਜਿਹਨਾਂ ਵਿੱਚ ਸਾਡੇ ਡੇਲੀ ਵਰਤੋਂ ਦੇ ਸਮਾਨ ਆਉਂਦੇ ਹਨ ਜਿਵੇਂ ਕਿ ਬਰੱਸ਼ ਨਾਅਣ ਲਈ ਸਾਬਣ ਅਤੇ ਕੱਪੜੇ ਧੋਣ ਲਈ ਸਾਬਣ ਅਤੇ ਕੱਪੜੇ ਧੋਣ ਲਈ ਸਰਫ਼ ਅਤੇ ਨੀਲ਼ ਅਤੇ ਪਸ਼ੂਆਂ ਲਈ ਫ਼ੀਡ ਅਤੇ ਖਲ ਅਤੇ ਚੋਕਰ ਅਤੇ ਸਨੈਕਸ ਲਈ ਚਿਪਸ ਵਗੈਰਾ ਕੁਰਕੂਰੇ ਅਤੇ ਬਿਸਕੁਟ ਆਦਿ ਉਸ ਦੁਕਾਨ 'ਤੇ ਖਰੀਦਦੇ ਹਨ ਉਸ ਕਿਉਂਕਿ ਇਹ ਦੁਕਾਨ ਸਾਡੇ ਘਰ ਦੇ ਬਹੁਤ ਨਜ਼ਦੀਕ ਹੈ ਇਸ ਲਈ ਅਸੀਂ ਡੇਲੀ ਉਸ ਦੁਕਾਨ 'ਤੇ ਆਉਣ ਜਾਣ ਕਰ ਸਕਦੇ ਹਨ ਅਤੇ ਸਾਨੂੰ ਕੋਈ ਖ਼ੇਚਲ ਨਹੀਂ ਹੁੰਦੀ ਅਤੇ ਅਸੀਂ ਡੇਲੀ ਇਸ ਦੁਕਾਨ 'ਤੇੇੇੇੇੇੇ ਸਮਾਨ ਖਰੀਦਦੇ ਹਨ